ਹਾਂਜੀ ਅਸੀਂ ਸਾਰਿਆਂ ਨਾਲ ਖਾਣਾ ਖਾਣ ਦਾ ਆਨੰਦ ਮਾਣਦੇ ਹਾਂ ਹਰ ਤਰ੍ਹਾਂ ਦੇ ਮੌਕੇ ਕੋਈ ਵਿਆਹ ਸ਼ਾਦੀ ਕੋਈ ਜਨਮ ਦਿਨ ਦੀ ਪਾਰਟੀ ਕੁਛ ਵੀ ਹੋਵੇ ਕੋਈ ਦਿਨ ਤਿਉਹਾਰ ਹੋਵੇ ਅਸੀਂ ਇਹੀ ਕੋਸ਼ਿਸ਼ ਕਰਦੇ ਹਾਂ ਕੋਈ ਅਸੀਂ ਇਹੀ ਸੋਚਦੇ ਰਹਿੰਦੇ ਹਾਂ ਕੋਈ ਦਿਨ ਆਵੇ ਕੋਈ ਤਿਉਹਾਰ ਆਵੇ ਕਿ ਅਸੀਂ ਸਾਰੇ ਰਲ ਮਿਲ ਕੇ ਖਾਣਾ ਖਾਈਏ ਕਦੀ ਸਾਡੇ ਕੋਈ ਕਿਸੇ ਦਾ ਜਨਮਦਿਨ ਆ ਜਾਂਦਾ ਫਿਰ ਅਸੀਂ ਸਾਰੇ ਆਪਾਂ ਇਕੱਠੇ ਹੋ ਕੇ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਸਾਰਿਆਂ ਨੂੰ ਇਹਨੂੰ ਮਤਲਬ ਬੁਲਾਵਾ ਸੱਦਾਂ ਦਿੰਦੇ ਹਾਂ ਕਿ ਅੱਜ ਵਾਰੀ ਵਾਰੀ ਸਿਰ ਅੱਜ ਸਾਡੇ ਘਰ ਹੈਗਾ ਅੱਜ ਤੁਸੀਂ ਸਾਡੇ ਘਰ ਖਾਣਾ ਖਾਉਗੇ ਇਸ ਕਰਕੇ ਇਹ ਸਾਨੂੰ ਬਹੁਤ ਹੀ ਆਨੰਦ ਆਉਂਦਾ ਕਿ ਅਸੀਂ ਹੋਰ ਵਾਰੀ ਵਾਰੀ ਸਿਰ ਬੁਲਾ ਕੇ ਕਿਸ ਦਿਨ ਕਦੀ ਆਪਣੇ ਘਰ ਕਦੀ ਕਿਸੇ ਦੇ ਘਰ ਇਕੱਠੇ ਇਸ ਤਰ੍ਹਾਂ ਹੌਲੀ ਹੌਲੀ ਕਿਸੇ ਨਾ ਕਿਸੇ ਅਸੀਂ ਮੌਕਾ ਲੱਭਦੇ ਰਹਿੰਦੇ ਹਾਂ ਕਿ ਕਦੋਂ ਇਕੱਠੇ ਹੋਈਏ ਕਦੋਂ ਖਾਣਾ ਖਾਈਏ ਅਤੇ ਸਾਨੂੰ ਬਹੁਤ ਹੀ ਵਧੀਆ ਲੱਗਦਾ ਕਿ ਅਸੀਂ ਸਾਰੇ ਇਕੱਠੇ ਹੋ ਕੇ ਆਪਾਂ ਖਾਂਦੇ ਹਾਂ ਵਿਆਹਾਂ ਵਿੱਚ ਤਾਂ ਆਮ ਅਸੀਂ ਦੇਖਦੇ ਹਾਂ ਕਿ ਸਾਰੇ ਮਤਲਬ ਇਕੱਠੇ ਹੁੰਦੇ ਹਾਂ ਅਤੇ ਇੰਨਾ ਕੁ ਅਸੀਂ ਆਪਾਂ ਮਨੋਰੰਜਨ ਅਸੀਂ ਉਹਦੀ ਜੋ ਉਸ ਚੀਜ਼ ਦਾ ਆਨੰਦ ਮਾਣਦੇ ਹਾਂ ਕਿ ਪਰਮਾਤਮਾ ਸ਼ੁਕਰ ਸਾਨੂੰ ਮਤਲਬ ਮੌਕਾ ਦਿੱਤਾ ਪਰਮਾਤਮਾ ਨੇ ਇੱਕ ਇ ਇਕੱਠ ਕਰਨ ਦਾ ਆਪਾਂ ਮਤਲਬ ਕਿ ਸਾਰੇ ਇਕੱਠੇ ਹੋ ਕੇ ਇੱਕ ਦੂਜੇ ਦੇ ਨਾਲ ਖਾਣਾ ਖਾਈਏ ਗੱਲਾਂ ਮਾਰੀਏ ਇੱਕ ਦੂਜੇ ਦੇ ਦੁੱਖ ਸੁੱਖ ਜੋ ਜਾਂ ਹਾਸੇ ਖੇਡੇ ਬਹੁਤ ਹੀ ਸਾਨੂੰ ਇਸ ਚੀਜ਼ ਦਾ ਆਨੰਦ ਆਉਂਦਾ ਕਿ ਆਪਾਂ ਜਦੋਂ ਇਕੱਠੇ ਹੋ ਕੇ ਇੱਕ ਪਰਿਵਾਰ ਰਿਸ਼ਤੇਦਾਰ ਇਕੱਠੇ ਹੋ ਕੇ ਆਪਾਂ ਇੱਕ ਪਾਰਟੀ ਦੇ ਉੱਤੇ ਅਸੀਂ ਇੱਕ ਜਗ੍ਹਾ 'ਤੇ ਬੈਠ ਕੇ ਖਾਣਾ ਖਾਂਦੇ ਹਾਂ ਸਾਨੂੰ ਇਹ ਬਹੁਤ ਹੀ ਵਧੀਆ ਲੱਗਦਾ ਜਿਵੇਂ ਕੋਈ ਧਾਰਮਿਕ ਹੈ ਕੋਈ ਗੁਰਮਤਿ ਸਮਾਗਮ ਹੈ ਸਾਡੇ ਬੜੀ ਦੁਨੀਆ ਜ਼ਰੂਰੀ ਨਹੀਂ ਸਾਡੇ ਰਿਸ਼ਤੇਦਾਰ ਹੀ ਹੋਣ ਬੜੀ ਦੁਨੀਆ ਦੇ ਵਿੱਚ ਲੋਕ ਹੈ ਪ੍ਰੇਮ ਭਾਵ ਵਾਲੇ ਹੁੰਦੇ ਨੇ ਬਹੁਤ ਜ਼ਿਆਦਾ ਹੁੰਦੇ ਆ ਅਸੀਂ ਉੱਥੇ ਵੀ ਇਸ ਚੀਜ਼ ਦਾ ਆਨੰਦ ਮਾਣਦੇ ਹਾਂ ਇਕੱਠੇ ਹੋ ਕੇ ਇੱਕ ਪੰਗਤ ਦੇ ਵਿੱਚ ਆਪਾਂ ਗੁਰਮਤਿ ਸਮਾਗਮ ਵਿੱਚ ਇੱਕ ਪੰਗਤ 'ਚ ਬਹਿ ਕੇ ਆਪਾਂ ਖਾਣਾ ਖਾਂਦੇ ਹਾਂ ਕੋਈ ਅਸੀਂ ਧਰਮ ਜਾਤ ਊਚ ਨੀਚ ਕੁਛ ਨਹੀਂ ਦੇਖਦੇ ਕਿ ਕੋਈ ਗਰੀਬ ਹੈ ਕੋਈ ਅਮੀਰ ਹੈ ਕੋਈ ਕਿਸੇ ਧਰਮ ਦਾ ਕੋਈ ਕੋਈ ਕਿਹੜੀ ਜਾਤ ਦਾ ਬੰਦਾ ਸਾਡੇ ਨਾਲ ਬੈਠਾ ਕੁਝ ਵੀ ਆਪਾਂ ਇਸ ਚੀਜ਼ ਨੂੰ ਕਦੀ ਵੀ ਇਸ ਚੀਜ਼ ਨੂੰ ਨਹੀਂ ਸੋਚਦੇ ਕਿ ਇਸ ਇਹ ਸਾਡੇ ਤੋਂ ਵੱਡਾ ਜਾਂ ਸਾਡੇ ਤੋਂ ਛੋਟਾ ਅਸੀਂ ਇਸ ਚੀਜ਼ ਦਾ ਆਨੰਦ ਮਾਣਦੇ ਕਿ ਅਸੀਂ ਇੱਕ ਪੰਗਤ ਵਿੱਚ ਬਹਿ ਕੇ ਇਕੱਠੇ ਹੋ ਕੇ ਅਸੀਂ ਆਪਣਾ ਖਾਣਾ ਖਾਣ ਦਾ ਅਨੰਦ ਮਾਣ ਰਹੇ ਹਾਂ ਕੋਈ ਪੂਜਾ ਹੋਵੇ ਕੋਈ ਭੋਗ ਹੋਵੇ ਕਿਸ ਕਿਸੇ ਤਰ੍ਹਾਂ ਦਾ ਵੀ ਕੋਈ ਵੀ ਮੌਕਾ ਹੁੰਦਾ ਅਸੀਂ ਇਸ ਚੀਜ਼ ਨੂੰ ਵਧੀਆ ਸਾਨੂੰ ਲੱਗਦਾ ਕਿ ਅਸੀਂ ਇੱਕ ਜਗ੍ਹਾ 'ਤੇ ਬੈਠ ਕੇ ਇਕੱਠੇ ਹੋ ਕੇ ਖਾਣਾ ਖਾ ਰਹੇ ਹਾਂ ਕੋਈ ਕਿਸੇ ਨੇ ਦਾਵਤ ਕੀਤੀ ਕਿਸੇ ਨੇ ਸਾਨੂੰ ਕਿਸੇ ਜਦ ਬੁਲਾਇਆ ਚਲ ਕੋਈ ਮਤਲਬ ਕਿਸੇ ਦੀ ਸਾਲਗਿਰਾ ਕਿਸੇ ਦਾ ਕੁਛ ਹੈ ਕੋਈ ਵੀ ਮੌਕਾ ਹੈ ਆਪਾਂ ਇਸ ਚੀਜ਼ ਨੂੰ ਕਦੀ ਨਹੀਂ ਅਸੀਂ ਇਹੀ ਮੌਕੇ ਲੱਭਦੇ ਰਹਿੰਦੇ ਕਿ ਅਸੀਂ ਕਦੋਂ ਇਕੱਠੇ ਹੋਈਏ ਕਿ ਕਦੋਂ ਖਾਣਾ ਖਾਈਏ ਇਸ ਕਰਕੇ ਸਾਨੂੰ ਸ ਸਦਾ ਮਤਲਬ ਇਕੱਠੇ ਰਹਿ ਕੇ ਹੀ ਖਾਣਾ ਖਾਣਾ ਚਾਹੀਦਾ ਔਰ ਸਾਨੂੰ ਅੱਛਾ ਚੰਗਾ ਲੱਗਦਾ ਕਿ ਅਸੀਂ ਆਪਾਂ ਇਕੱਠੇ ਹੋ ਕੇ ਇੱਕ ਆਪਾਂ ਆਨੰਦ ਮਾਣ ਰਹੇ ਹਾਂ ਇੱਕ ਜਗ੍ਹਾ 'ਤੇ ਇਕੱਠੇ ਹੋ ਕੇ ਸਾਰੇ ਭੈਣ ਭਰਾ ਰਿਸ਼ਤੇਦਾਰ ਇਕੱਠੇ ਹੋ ਕੇ ਅਸੀਂ ਇੱਕ ਜਗ੍ਹਾ 'ਤੇ ਬਹਿ ਕੇ ਖਾਣਾ ਖਾ ਰਹੇ ਹਾਂ ਧੰਨਵਾਦ